ਇੱਕ ਵਾਰ ਸਾਡੇ ਸਕੂਲ ਵਿੱਚ ਚਿੱਤਰਕਾਰੀ ਦਾ ਮੁਕਾਬਲਾ ਹੋਇਆ ਮੈਂ ਉਸ ਮੁਕਾਬਲੇ ਵਿੱਚ ਭਾਗ ਲਿਆ ਸੀ ਕਿਉਂਕਿ ਮੇਰੀ ਡਰੋਇੰਗ ਬਹੁਤ ਵਧੀਆ ਹੈ ਮੈਂ ਇਸ ਮੁਕਾਬਲੇ ਲਈ ਬਹੁਤ ਉਤਸ਼ਾਹਿਤ ਸੀ ਮੁਕਾਬਲੇ ਵਿੱਚ ਸਾਨੂੰ ਅਸਮਾਨ ਵਿੱਚ ਉਡਦੇ ਪੰਛੀਆਂ ਦੀ ਡਰੋਇੰਗ ਬਣਾਉਣ ਦਾ ਟਾਸਕ ਦਿੱਤਾ ਗਿਆ ਸਾਡੇ ਕੋਲ ਦਸ ਮਿੰਟ ਦਾ ਸਮਾਂ ਸੀ ਇਹ ਡਰੋਇੰਗ ਬਣਾਉਣੀ ਮੇਰੇ ਲਈ ਬਹੁਤ ਆਸਾਨ ਸੀ ਅਤੇ ਮੈਂ ਸਭ ਤੋਂ ਪਹਿਲਾਂ ਤਸਵੀਰ ਬਣਾ ਲਈ ਮੁਕਾਬਲੇ ਦੇ ਅੰਤ ਵਿੱਚ ਜਦੋਂ ਅਧਿਆਪਕਾਂ ਨੇ ਸਭ ਦੀਆਂ ਤਸਵੀਰਾਂ ਦੇਖੀਆਂ ਤਾਂ ਉਹਨਾਂ ਨੇ ਮੇਰੀ ਤਸਵੀਰ ਨੂੰ ਬਹੁਤ ਪਸੰਦ ਕੀਤਾ ਅਤੇ ਮੁਕਾਬਲੇ ਵਿੱਚ ਮੈਂ ਪਹਿਲਾ ਸਥਾਨ ਜਿੱਤਿਆ ਅਤੇ ਮੈਨੂੰ ਬਹੁਤ ਖੁਸ਼ੀ ਮਿਲੀ ਧੰਨਵਾਦ